ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਸਨਮੀਤ ਸਿੰਘ ਬੋਲ ਰਿਹਾ ਖਾਲਸਾ ਪੁਰ ਰੋਡ ਤਰਨ ਤਾਰਨ ਤੋਂ ਮੈਂ ਉਬਰ ਸਰਵਿਸਿਸ ਤੁਸ ਤੁਸੀਂ ਉਬਰ ਸਰਵਿਸਿਸ ਤੋਂ ਬੋਲ ਰਹੇ ਹੋ ਕੱਲ੍ਹ ਮੈਂ ਤੁਹਾਡੀ ਸਰਵਿਸ ਯੂਜ ਕੀਤੀ ਸੀਗੀ ਮੈਂ ਆਫਿਸ ਜਾਣਾ ਸੀਗਾ ਇਸ ਲਈ ਮੈਂ ਉਬਰ ਦੀ ਕਾਰ ਬੁੱਕ ਕੀਤੀ ਸੀਗੀ ਜਿਹਦਾ ਕਿ ਮੈਨੂੰ ਕਾਫ਼ੀ ਜਿਹੜਾ ਵੀ ਕਾਫ਼ੀ ਖਰਾਬ ਰਿਸਪਾਂਸ ਰਿਹਾ ਕਿਉਂਕਿ ਕਾਰ ਦੀਆਂ ਸੀਟਸ ਵਗੈਰਾ ਦੇ ਕਵਰ ਸਾਰੇ ਖਰਾਬ ਸੀਗੇ ਐਂਡ ਕਾਰ ਦੇ ਵਿੱਚ ਕੋਈ ਵੀ ਸਫਾਈ ਨਹੀਂ ਸੀਗੀ ਕਾਫ਼ੀ ਗੰਦ ਵਗੈਰਾ ਪਿਆ ਹੋਇਆ ਸੀਗਾ ਸੀਟਸ ਵਗੈਰਾ 'ਤੇ ਵੀ ਮਿੱਟੀ ਵਗੈਰਾ ਜੰਮੀ ਹੋਈ ਸੀਗੀ ਐਂਡ ਡਰਾਈਵਰ ਡਰਾਈਵਰ ਦਾ ਗੱਲ ਕਰਨ ਤੋਂ ਤਰੀਕਾ ਵੀ ਬਿਲਕੁਲ ਸਹੀ ਨਹੀਂ ਸੀਗਾ ਐਂਡ ਉਸ ਉਸ ਦੀ ਕਾਰ ਦਾ ਹੋਰ ਹੋਰਨ ਵੀ ਸਹੀ ਨਹੀਂ ਸੀਗਾ ਕਾਫ਼ੀ ਵਾਰ ਐਕਸੀਡੈਂਟ ਹੁੰਦਾ ਬਚ ਗਿਆ ਅਤੇ ਕਾਰ ਕਾਰ ਵਿੱਚ ਚੱਲਦੀ ਚੱਲਦੀ ਬੰਦ ਵੀ ਹੋ ਰਹੀ ਸੀ ਦੋ ਤਿੰਨ ਵਾਰ ਬੰਦ ਹੋ ਚੁੱਕੀ ਐਂਡ ਪੰਚਰ ਵੀ ਹੋ ਗਿਆ ਸੀ ਜਿਹਦੇ ਕਰਕੇ ਮੈਂ ਮੀਟਿੰਗ 'ਤੇ ਬਹੁਤ ਲੇਟ ਪਹੁੰਚਿਆ ਮੇਰੀ ਮੀ ਮੇਰੇ ਔਫਿਸ ਦੇ ਕੰਮ ਦਾ ਨੁਕਸਾਨ ਵੀ ਹੋਇਆ ਵਾ ਮੇਰੇ ਹੋਰ ਵੀ ਖਰਚਾ ਹੋਇਆ ਮੈਨੂੰ ਦੁਬਾਰਾ ਦੂਸਰੀ ਟੈਕਸੀ ਕਰਕੇ ਜਾਣਾ ਪਿਆ ਉਹਦਾ ਖਰਚਾ ਅਲੱਗ ਤੋਂ ਹੋਇਆ ਵਾ ਇਸ ਕਰਕੇ ਅਗਰ ਸਰਵਿਸ ਨਹੀਂ ਵੈਸਟ ਹੈਗੀ ਤਾਂ ਕਸਟਮਰ ਯੂਜ਼ ਨਹੀਂ ਕਰੇਗਾ ਇਸ ਨੂੰ ਇਸ ਕਰਕੇ ਤੁਹਾਨੂੰ ਸਰਵਿਸ ਮੈਂਟੇਨ ਕਰਨੀ ਚਾਹੀਦੀ ਹੈ ਜਿ ਜਿਹਦੇ ਨਾਲ ਕਿ ਬਾਕੀ ਕਸਟਮਰ ਵੀ ਸੈਟਿਸਫਾਈ ਹੋਣ ਐਂਡ ਤੁਹਾਡੀ ਸ ਕੰਮ ਵੀ ਤਾਂ ਹੀ ਵਧੀਆ ਚੱਲੇਗਾ ਜੇ ਕਸਟਮਰ ਸੈਟਿਸਫਾਈ ਹੋਣਗੇ ਤਾਂ ਹੀ ਅੱਗੇ ਤੁਹਾਡੀ ਵੀ ਪ੍ਰਮੋਸ਼ਨ ਵਗੈਰਾ ਸਹੀ ਹੋਵੇਗੀ